ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨਾਲ ਕਾਫੀ ਬੁਨਿਆਦੀ ਢਾਂਚੇ ਅਤੇ ਸਰੋਤਾਂ ਦੀ ਸਮੱਸਿਆ ਨੂੰ ਬਹੁਤ ਸਾਰੇ ਤਰੀਕਿਆਂ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕਿ ਇੱਕ ਸਕੀਮ ਚੱਲ ਰਹੀ ਹੈ ਫੰਡਿੰਗ ਸਕੀਮ ਜਿਹਦੇ ਵਿੱਚ ਜੋ ਸਕੂਲ ਹੁੰਦੇ ਹਨ ਉਹਨਾਂ ਨੂੰ ਫੰਡਸ ਵਗੈਰਾ ਜਿਹੜੇ ਉਹ ਦਿੱਤੇ ਜਾਂਦੇ ਆ ਤਾਂ ਕਿ ਉਹ ਆਪਣਾ ਜੋ ਵੀ ਸਕੂਲ ਦੇ ਵਿੱਚ ਜੋ ਵੀ ਉਹਨਾਂ ਦੀਆਂ ਮੇਨ ਮੁਸ਼ਕਲਾਂ ਆ ਰਹੀਆਂ ਹਨ ਚਾਹੇ ਉਹ ਸ ਢਾਂਚੇ ਨੂੰ ਲੈ ਕੇ ਹੋਣ ਚਾਹੇ ਟੀਚਰਸ ਵਗੈਰਾ ਨੂੰ ਲੈ ਕੇ ਹੋਣ ਉਹਨਾਂ ਸਾਰਿਆਂ ਨੂੰ ਉਹ ਜਿਹੜਾ ਆ ਉਹ ਖਤਮ ਕਰ ਸਕਣ ਇਹ ਤੋਂ ਬਿਨਾਂ ਡਿਵੈਲਪਮੈਂਟ ਸਕੀਮ ਚੱਲਦੀਆਂ ਹੈ ਡਿਵੈਲਪਮੈਂਟ ਸਕੀਮ ਦੇ ਵਿੱਚ ਕੀ ਹੁੰਦਾ ਆ ਕਿ ਜਿਹੜੀਆਂ ਬਿਲਡਿੰਗਸ ਆ ਉਹ ਬਣਾਈਆਂ ਜਾਂਦੀਆਂ ਸਕੂਲਸ ਦੇ ਲਈ ਜੋ ਵੀ ਜਿਹੜੇ ਅਧਿਆਪਕ ਹੁੰਦੇ ਆ ਉਹਨਾਂ ਨੂੰ ਮੁੱਢਲੀ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਆ ਤਾਂ ਕਿ ਉਹ ਬੱਚਿਆਂ ਨੂੰ ਵਧੀਆ ਢੰਗ ਦੇ ਨਾਲ ਪੜ੍ਹਾ ਸਕਣ ਸੋ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਕੀਮਸ ਆ ਉਹ ਚਲਾ ਰਹੀ ਹੈ ਸਰਕਾਰ ਇਸ ਟਾਈਮ 'ਤੇ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਆ ਉਹਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕੀਤਾ ਜਾ ਸਕੇ ਅਤੇ ਹਰ ਇੱਕ ਬੱਚੇ ਨੂੰ ਜਿਹੜੀ ਮੁੱਢਲੀ ਸਿੱਖਿਆ ਆ ਉ ਉਹ ਦਿੱਤੀ ਜਾ ਸਕੇ ਸੋ ਇਹਦੇ ਲਈ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਆ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਹੋਈਆਂ ਆ